ਸਤਿ ਸ਼੍ਰੀ ਅਕਾਲ ਜੀ ਮੈਨੂੰ ਪੁਰਾਣੀਆਂ ਅਤੇ ਨਵੀਆਂ ਖੇਡਾਂ ਬਹੁਤ ਹੀ ਪਸੰਦ ਹਨ ਨਵੀਆਂ ਖੇਡਾਂ ਵਿਚ ਜਿਵੇਂ ਕ੍ਰਿਕਟ ਫੁਟਬਾਲ ਬੋਲੀਬਾਲ ਗਤਕਾ ਕਬੱਡੀ ਆਦਿ ਮੇਰੀਆਂ ਮਨਪਸੰਦ ਖੇਡਾਂ ਹਨ ਮੈਨੂੰ ਸਪੋਰਟਸ ਵਾਲੇ ਚੈਨਲ ਵੀ ਬਹੁਤ ਪਸੰਦ ਹਨ ਮੈਂ ਖੇਡਾਂ ਦੀਆਂ ਖਬਰਾਂ ਅਤੇ ਸਮਾਗਮਾਂ ਨੂੰ ਦੇਖਣ ਲਈ ਫੋਨ ਵਿੱਚ ਵੀ ਸਪੋਰਟਸ ਨਾਲ ਰਿਲੇਟਡ ਬਹੁਤ ਸਾਰੀਆਂ ਐਪਸ ਯੂਜ ਕਰਦੀ ਹਾਂ ਅਤੇ ਟੀਵੀ ਉੱਪਰ ਵੀ ਸਪੋਰਟਸ ਚੈਨਲ ਬਹੁਤ ਹਨ ਅਤੇ ਮੈਂ ਉਹ ਵੀ ਦੇਖਦੀ ਹਾਂ ਮੈਨੂੰ ਇਹਨਾਂ ਨੂੰ ਦੇਖਣ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਖੇਡਾਂ ਸਾਨੂੰ ਕਿ ਕਿਹੜੀ ਟੀਮ ਨਾਲ ਕਦੋਂ ਮੁਕਾਬਲਾ ਹੋਣਾ ਹੈ ਕਿੱਥੇ ਹੋਣਾ ਹੈ ਸਾਰਾ ਕੁਛ ਪਤਾ ਲੱਗਦਾ ਹੈ ਇਹਨਾਂ ਖੇਡਾਂ ਨਾਲ ਅਪ ਟੂ ਡੇਟ ਰਹਿਣ ਨਾਲ ਸਾਨੂੰ ਬਹੁਤ ਸਾਰੇ ਕਰੰਟ ਆਫੇਅਰਸ ਬਾਰੇ ਵੀ ਪਤਾ ਚੱਲਦਾ ਹੈ ਜਿਵੇਂ ਅਸੀਂ ਇਗਜ਼ਾਮ ਦਿੰਦੇ ਹਾਂ ਵਰਲਡ ਕੱਪ ਨਾਲ ਰਿਲੇਟਡ ਬਹੁਤ ਸਾਰੇ ਕੁਸ਼ਚਨਸ ਪੇਪਰ ਵਿੱਚ ਪੁੱਛੇ ਜਾਂਦੇ ਹਨ ਤਾਂ ਜੋ ਅਸੀਂ ਇਹਨਾਂ ਦੇ ਸਹੀ ਆਨਸਰ ਦੇ ਸਕੀਏ ਸਾਨੂੰ ਗੇਮਸ ਬਾਰੇ ਅਤੇ ਗੇਮ ਨਾਲ ਅਪ ਅਪਡੇਟ ਰਹਿਣਾ ਰਹਿਣਾ ਚਾਹੀਦਾ ਹੈ ਜਿਵੇਂ ਕਿ ਪੰਜਾਬ ਦੀਆਂ ਰਿਵਾਇਤੀ ਖੇਡਾਂ ਨੂੰ ਉਤਸ਼ਾਹ ਕਰਨ ਲਈ ਪੰਜਾਬ ਸਰਕਾਰ ਨੇ ਦੋ ਹਜ਼ਾਰ ਚੌਦ੍ਹਾਂ ਤੋਂ ਪੰਜਾਬੀ ਦਿਹਾਇਤੀ ਖੇਡਾਂ ਨੂੰ ਉਤਸ਼ਾਹ ਕਰਨ ਲਈ ਪਹਿਲਕਦਮੀਆਂ 'ਤੇ ਕੰਮ ਕੀਤਾ ਹੈ ਇਹਨਾਂ ਖੇਡਾਂ ਵਿੱਚੋਂ ਕਬੱਡੀ ਕੁਸ਼ਤੀ ਨੂੰ ਰਾਜ ਪੱਧਰ 'ਤੇ ਰਾਸ਼ਟਰੀ ਪੱਧਰ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਉੱਪਰ ਵੀ ਮਾਨਤਾ ਮਿਲੀ ਹੈ ਜਿਵੇਂ ਕਿ ਕ੍ਰਿਕਟ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਬਣਾਈ ਗਈ ਹੈ ਕਿੰਗਸ ਇਲੈਵਨ ਪੰਜਾਬ ਇੱਕ ਮੋਹਾਲੀ ਪੰਜਾਬ ਵਿੱਚ ਅਧਾਰਿਤ ਇੱਕ ਫਰੈਂਚਾਈਜ ਕ੍ਰਿਕਟ ਟੀਮ ਹੈ ਜੋ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡੀ ਜਾਂਦੀ ਹੈ ਕੁਝ ਕੁ ਖੇਡਾਂ ਜਿਵੇਂ ਗੱਤਕਾ ਕਬੱਡੀ ਹਾਕੀ ਫੁਟਬਾਲ ਕ੍ਰਿਕਟ ਕਬੱਡੀ ਭਾਰਤ ਦੀ ਸਭ ਤੋਂ ਜ਼ਿਆਦਾ ਲੋਕਪ੍ਰਿਯਾ ਖੇਡਾਂ ਵਿੱਚੋਂ ਇੱਕ ਹੈ ਅਤੇ ਇਹ ਖੇਡ ਪਿੰਡ ਦੇ ਲੋਕਾਂ ਵੱਲੋਂ ਜ਼ਿਆਦਾ ਖੇਡੀ ਜਾਂਦੀ ਹੈ ਕਬੱਡੀ ਮੇਰੀ ਸਭ ਤੋਂ ਮਨਪਸੰਦ ਗੇਮ ਹੈ ਅਤੇ ਮੈਂ ਇਸ ਦੀ ਖਿਡਾਰਨ ਵੀ ਹਾਂ ਇਸ ਲਈ ਮੈਂ ਤੁਹਾਨੂੰ ਕਬੱਡੀ ਬਾਰੇ ਕੁਝ ਕੁ ਗੱਲਾਂ ਦੱਸਣਾ ਚਾਹਵਾਂਗੀ ਕਬੱਡੀ ਦੀ ਟੀਮ ਵਿੱਚ ਦੋ ਟੀਮਾਂ ਹੁੰਦੀਆਂ ਹਨ ਅਤੇ ਆਪਣੇ ਆਪਣੇ ਹਿੱਸਿਆਂ ਵਿੱਚ ਜਾ ਕੇ ਜਿਹੜੇ ਖਿਡਾਰੀ ਹੁੰਦੇ ਹਨ ਉਹ ਖੜ੍ਹ ਜਾਂਦੇ ਹਨ ਇੱਕ ਇੱਕ ਖਿਡਾਰੀ ਆਪਣੀ ਹਿੱਸਿਆਂ ਦੀ ਰੇਡ ਪਾਉਣ ਲਈ ਜਾਂਦੇ ਹਨ ਅਤੇ ਦੂਸਰੇ ਗੁੱਟ ਦੇ ਖਿਡਾਰੀ ਨੂੰ ਹੱਥ ਲਾ ਕੇ ਵਾਪਿਸ ਆਉਣ 'ਤੇ ਇੱਕ ਅੰਕ ਦਿੱਤਾ ਜਾਂਦਾ ਹੈ ਦੂਸਰੇ ਗੁੱਟ ਦੇ ਜਾਫੀਆਂ ਦਾ ਕੰਮ ਹੁੰਦਾ ਹੈ ਧਾਵੀਆਂ ਨੂੰ ਰੋਕਣਾ ਅਤੇ ਅਜਿਹਾ ਕਰਨ 'ਤੇ ਵੀ ਉਹਨਾਂ ਨੂੰ ਅੰਕ ਮਿਲਦੇ ਹਨ ਚਕਰਾਕਰ ਕਬੱਡੀ ਜਿਸ ਨੂੰ ਸਰਕਲ ਸਟਾਇਲ ਕਬੱਡੀ ਨੂੰ ਕਬੱਡੀ ਵੀ ਕਿਹਾ ਜਾਂਦਾ ਹੈ ਇਸ ਵਿੱਚ ਕਬੱਡੀ ਕਬੱਡੀ ਬੋਲਣਾ ਜ਼ਰੂਰੀ ਨਹੀਂ ਹੁੰਦਾ ਭਾਰਤ ਨੇ ਚਾਰ ਏਸ਼ੀਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਚਾਰਾਂ ਵਿੱਚ ਸਵਰਨ ਪਦਕ ਹਾਸਿਲ ਕੀਤਾ ਭਾਰਤ ਵਿੱਚ ਚਾਰ ਪ੍ਰਕਾਰ ਦੀ ਕਬੱਡੀ ਖੇਡੀ ਜਾਂਦੀ ਹੈ ਅਤੇ ਇਹਨਾਂ ਦੇ ਨਾਮ ਹਨ ਅਵਰ ਸੁਰਾਜੀਵੀ ਹੱਥ ਤੂੰ ਆਤੇ ਜਮੀਨੀ ਅਮਰ ਮੁੱਖ ਤੌਰ 'ਤੇ ਪੰਜਾਬ ਹਰਿਆਣਾ ਕਨੇਡਾ ਅਤੇ ਦੁਨਿਆਜਾ ਦੇ ਹੋਰ ਹਿੱਸਿਆਂ ਵਿੱਚ ਪੰਜਾਬੀ ਖਿਡਾਰੀ ਵੱਲੋਂ ਖੇਡੀਆਂ ਜਾਂਦੀਆਂ ਹਨ ਭਾਰਤ ਨੂੰ ਇਹ ਵੀ ਵਿਸ਼ਵ ਦੀ ਪਹਿਲੀ ਕਬੱਡੀ ਲੀਗ ਦਾ ਮੇਜਬਾਨ ਹੈ ਲੀਗ ਫਾਰਮੂਲਾ ਇੱਕ ਸੈਰ ਖੇਡ ਫ਼ੋਰਮੈਟ ਨੂੰ ਹੇਠ ਅਤੇ ਅਗਸਤ ਤੱਕ ਦਸੰਬਰ ਦੋ ਹਜ਼ਾਰ ਚੌਦ੍ਹਾਂ ਤੱਕ ਸ਼ੁਰੂ ਕਰਨ ਚਾਰ ਖਿੱਤੇ ਭਰ ਵਿੱਚ ਖੇਡਿਆ ਜਾਵੇਗਾ ਇਹ ਰਾਜ ਦੇ ਜਿੱਥੇ ਸਾਧੂਗੁਧੂ ਦੇ ਸੰਬੰਧਿਤ ਖੇਡ ਹੈ ਖੇਡੀ ਹੈ ਕਿ ਭਾਰਤ ਚੇ ਪੰਜਾਬ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੀ ਖੇਡ ਹੈ ਅਤੇ ਭਾਰਤ ਵਿੱਚ ਮਹਾਰਾਸ਼ਟਰ ਇਹ ਮਜ਼ੇਦਾਰ ਲਈ ਬ੍ਰਿਟਿਸ਼ ਫੌਜ ਕੇ ਖੇਡਿਆ ਹੈ ਭਾਰਤ ਨੇ ਦੋ ਹਜ਼ਾਰ ਤੇਰ੍ਹਾਂ ਵਿਸ਼ਵ ਕਬੱਡੀ ਕੱਪ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਭਾਰਤ ਵਿੱਚ ਜਿੱਤ ਹਾਸਿਲ ਕੀਤੀ ਸੀ ਉੱਥੇ ਸ਼ਬਦ ਦਾ ਕਬੱਡੀ ਦੇ ਆਰੰਭ ਕਰਨ ਦੇ ਲਈ ਰੂਪ ਵਿੱਚ ਕੋਈ ਸਹਿਮਤੀ ਨਹੀਂ ਸ਼ਬਦ ਦਾ ਕਬੱਡੀ ਦਾ ਤਾਮਿਲ ਸ਼ਬਦ ਤੱਕ ਲਿਆ ਗਿਆ ਹੈ ਉੱਨੀ ਸੌ ਚੁਰਾਨ ਭਾਰਤ ਨੇ ਸੋਨੇ ਦਾ ਤਗਮਾ ਵੀ ਜਿੱਤਿਆ ਸੀ ਭਾਰਤ ਨੇ ਉੱਨੀ ਸੌ ਅੱਸੀ ਵਿੱਚ ਇਸ ਕਬ ਕਬੱਡੀ ਦੀ ਏਸ਼ੀਆਈ ਕਬੱਡੀ ਜੇਤੂ ਪ੍ਰਬੰਧ ਕੀਤਾ ਗਿਆ ਸੀ ਅਤੇ ਭਾਰਤ ਜੇਤੂ ਅਤੇ ਬੰਗਲਾਦੇਸ਼ ਰਨਰ ਆਫ ਦੇ ਤੌਰ 'ਤੇ ਉਭਰੇ ਬੰਗਲਾਦੇਸ਼ ਏਸ਼ੀਆਈ ਕਬੱਡੀ ਜੇਤੂ ਜੈਪੁਰ ਭਾਰਤ ਵਿੱਚ ਆਯੋਜਿਤ ਵਿੱਚ ਦੌੜਾਕ ਅੱਪ ਨੂੰ ਫਿਰ ਉੱਨੀ ਸੌ ਪਚਾਸੀ ਵਿੱਚ ਬਣ ਗਿਆ ਮੁਕਾਬਲੇ 'ਚ ਹੋਰ ਟੀਮ ਨੇਪਾਲ ਮਲੇਸ਼ੀਆ ਅਤੇ ਜਪਾਨ ਸਨ ਖੇਡ ਨੂੰ ਪਹਿਲਾਂ ਉੱਨੀ ਸੌ ਨੱਬੇ ਭਾਰਤ ਚੀਨ ਜਪਾਨ ਮਲੇਸ਼ੀਆ ਸ਼੍ਰੀ ਲੰਕਾ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਬਿਜ਼ਿੰਗ ਵਿੱਚ ਏਸ਼ੀਆਈ ਖੇਡ ਵਿੱਚ ਵਾਰ ਵਾਰ ਸ਼ਾਮਿਲ ਕੀਤਾ ਗਿਆ ਸੀ ਭਾਰਤ ਨੇ ਸੋਨੇ ਦਾ ਤਗਮਾ ਜਿੱਤਿਆ ਸੀ ਅਤੇ ਇਹ ਵੀ ਹੇਠ ਉੱਨੀ ਸੌ ਚੁਰਾਨਵੇਂ ਵਿੱਚ ਹੀਰੋਸ਼ੀਮਾ ਵਿੱਚ ਛੇ ਏਸ਼ੀਆਈ ਖੇਡ ਬੈਂਕੋਕ ਉੱਨੀ ਸੌ ਅਠਾਨਵੇਂ ਵਿੱਚ ਬੁਸਾਨ ਦੋ ਹਜ਼ਾਰ ਦੋ ਵਿੱਚ ਦੋ ਹਜ਼ਾਰ ਛੇ ਵਿੱਚ ਦੋਹਾ ਅਤੇ ਵੁਭਾਨ ਦੋ ਹਜ਼ਾਰ ਦਸ ਵਿੱਚ ਅਤੇ ਸੋਨੇ ਦੇ ਜਿੱਤਿਆ ਹੈ ਬਰਤਾਨਵੀਆਂ ਨੇ ਕਬੱਡੀ ਹਰਮਨ ਕਰਨ ਦੀ ਖੋਜ ਚੈਨਲ ਚਾਰ ਜੋ ਖੇਡ ਨੂੰ ਸਮਰਪਿਤ ਇਕ ਪ੍ਰੋਗਰਾਮ ਨੂੰ ਹੁਕਮ ਦੇ ਕੇ ਕੀਤਾ ਗਿਆ ਸੀ ਪ੍ਰੋਗਰਾਮ ਨੂੰ ਕਬੱਡੀ ਦੇ ਸ਼ੁਰੂ ਵਿੱਚ ਉੱਨੀ ਸੌ ਨੱਬੇ ਵਿੱਚ ਪਰ ਅਜਿਹੇ ਪੱਛਮੀ ਬੰਗਾਲ ਪੁਲਿਸ ਨੇ ਪੰਜਾਬ ਦੇ ਬਨਾਮ ਤੌਰ 'ਤੇ ਵਾਂਡੇ ਦੇ ਬਾਵਜੂਦ ਦਰਸ਼ਕ ਦਾ ਧਿਆਨ ਨੂੰ ਹਾਸਿਲ ਕਰਨ ਲਈ ਅਸਫਲ ਹੈ ਕਬੱਡੀ ਉੱਨੀ ਸੌ ਬਾਨਵੇਂ ਅਲਟ ਚਨਾ ਚਟਾਨ ਪਹਿਰੇਦਾਰ ਵਿੱਚ ਬਾਹਰ ਗਿਆ ਸੀ ਕੂਪਰ ਮਦਰ ਧਾਰਾ ਦੋ ਹਜਾਰ ਇਕ ਵਿੱਚ ਇੱਕ ਕਬੱਡੀ ਟੀਮ ਦਾ ਗਠਨ ਕੀਤਾ ਅਤੇ ਇੱਕ ਪੜਾਅ 'ਤੇ ਸਨ ਬ੍ਰਿਟਿਸ਼ ਘਰੇਲੂ ਵਿੱਚ ਸਤਦ ਦਾ ਦਰਜਾ ਦਿੱਤਾ ਗਿਆ ਹੈ ਸੋ ਸਾਨੂੰ ਨਵੀਆਂ ਨਵੀਆਂ ਗੇਮਸ ਬਾਰੇ ਜਾਣਕਾਰੀ ਸਾਨੂੰ ਟੀਵੀ ਦੇ ਚੈਨਲ ਸਪੋਰਟਸ ਨਿਊਜ਼ 'ਤੇ ਉਹਨਾਂ ਤੋਂ ਮਿਲਦੇ ਰਹਿੰਦੇ ਹੈ ਸਾਨੂੰ ਉਹਨਾਂ ਦੇ ਖਿਡਾਰੀਆਂ ਬਾਰੇ ਪਤਾ ਲੱਗਦਾ ਰਹਿੰਦਾ ਹੈ ਅਤੇ ਵੱਖ ਵੱਖ ਦੇਸ਼ਾਂ ਦੇ ਖਿਡਾਰੀ ਕਿਵੇਂ ਖੇਡਦੇ ਹਨ ਕਿਹੜਾ ਖਿਡਾਰੀ ਸਾਡੇ ਲਈ ਮੈਨੂੰ ਵਿਰਾਟ ਕੋਹਲੀ ਮੇਰਾ ਬਹੁਤ ਮਨਪਸੰਦ ਕ੍ਰਿਕਟ ਖਿਡਾਰੀ ਹੈ ਧੰਨਵਾਦ